ਵੈਸੇ ਤਾਂ ਮੈਂ ਇੱਕ ਵਰਕਿੰਗ ਇੰਪਲੋਈ ਹਾਂ ਪਰ ਮੇਰਾ ਅੱਧ ਤੋਂ ਜ਼ਿਆਦਾ ਸਮਾਂ ਏ ਜਿਹੜਾ ਉਹ ਰਸੋਈ ਦੇ ਵਿੱਚ ਲੰਘਦਾ ਹੈ ਕਿਉਂਕਿ ਮੈਂ ਸਵੇਰੇ ਵੀ ਖਾਣਾ ਬਣਾ ਕੇ ਆਉਂਦੀ ਹਾਂ ਸ਼ਾਮ ਨੂੰ ਵੀ ਜਾ ਕੇ ਖਾਣਾ ਬਣਾਉਣਾ ਹੁੰਦਾ ਇਸ ਲਈ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਵੀ ਆ ਅਤੇ ਮੇਰਾ ਸਮਾਂ ਲੰਘਦਾ ਵੀ ਆ ਕਿਉਂਕਿ ਫੈਮਲੀ ਨੂੰ ਖਾਣਾ ਵੀ ਦੇਣਾ ਜ਼ਰੂਰੀ ਆ ਇਸ ਲਈ ਸਾਰਾ ਕੰਮ ਮੈਂ ਹੀ ਕਰਦੀ ਹਾਂ ਖਾਣਾ ਬਣਾਉਣ ਦਾ ਸਵੇਰੇ ਵੀ ਅਤੇ ਸ਼ਾਮ ਨੂੰ ਵੀ ਸਵੇਰੇ ਵੀ ਸਾਰੇ ਟਿਫਨ ਵਗੈਰਾ ਪੈਕ ਕਰਕੇ ਆਉਂਦੀ ਹਾਂ ਅਤੇ ਸ਼ਾਮ ਨੂੰ ਵੀ ਜਾ ਕੇ ਖਾਣਾ ਦੇਣਾ ਹੁੰਦਾ ਆ ਬਣਾ ਕੇ ਮੇਰਾ ਅੱਧ ਤੋਂ ਜ਼ਿਆਦਾ ਸਮਾਂ ਜਿਹੜਾ ਰਸੋਈ ਦੇ ਵਿੱਚ ਲੰਘਦਾ ਆ ਅਤੇ ਮੈਨੂੰ ਕੋਈ ਵੀ ਸਮਾਨ ਖਾਣ ਪੀਣ ਦਾ ਬਿਨਾਂ ਰੈਸਪੀ ਤੋਂ ਬਣਾਉਣਾ ਵਧੀਆ ਲੱਗਦਾ ਆ ਕਿਉਂਕਿ ਮੈਨੂੰ ਐਂ ਇੰਝ ਲੱਗਦਾ ਹੈ ਵੀ ਜੇ ਮੈਂ ਕਿਸੇ ਚੀਜ਼ ਨੂੰ ਦੇਖ ਕੇ ਬਣਾਵਾਂਗੀ ਤਾਂ ਉਹਦੇ 'ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਇਸ ਲਈ ਮੈਂ ਬਿਨਾਂ ਰੈਸਪੀ ਤੋਂ ਹੀ ਆਪਣਾ ਭੋਜਨ ਤਿਆਰ ਕਰਦੀ ਹਾਂ ਅਤੇ ਬਹੁਤ ਸ ਸਵਾਦਿਸ਼ਟ ਬਣਾ ਲੈਂਦੀ ਹਾਂ